ਹੈਲੋ

ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਕਲੱਬ ਕੁਆਡੀਨੇਟਰ ਹੀ ਗੱਲ ਕਰਦੀ ਹਾਂ ਹਾਂਜੀ ਤੁਸੀਂ ਕਿੱਥੋਂ ਬੋਲ ਰਹੇ ਹੋ ਅੱਛਾ ਅੱਛਾ ਹਾਂਜੀ ਹਾਂਜੀ ਦੱਸੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੇਖੋ ਆਪਣੇ ਮਤਲਬ ਆਪਣੇ ਕਲੱਬ ਦੇ ਵਿੱਚ ਆਪਾਂ ਨਾ ਏਜ ਗਰੁੱਪ ਦੇ ਅਕੋਡਿੰਗ ਬੱਚਿਆਂ ਨੂੰ ਡਿਵਾਇਡ ਕੀਤਾ ਹੋਇਆ ਅਲੱਗ ਅਲੱਗ ਐਕਟੀਵੀਟੀਜ ਦੇ ਵਿੱਚ ਅਤੇ ਤੁਸੀਂ ਦੱਸ ਸਕਦੇ ਹੋ ਵੀ ਤੁਹਾਡੇ ਮਤਲਬ ਕਿੰਨੇ ਬੱਚੇ ਨੇ ਵੀ ਜਿਹੜੇ ਪਾਰਟੀਸਪੇਟ ਕਰਨਾ ਚਾਹੁੰਦੇ ਨੇ

ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਅੱਛਾ ਅੱਛਾ ਹਾਂਜੀ ਹਾਂਜੀ ਦੇਖੋ ਮੈਡਮ ਸਾਡੇ ਇੱਥੇ ਆਪਣੇ ਮਾਈਂਡ ਗੇਮਜ਼ ਹੋ ਗਈਆਂ ਹੈ ਨਾ ਉਹਦੀਆਂ ਕਈ ਐਕਟੀਵੀਟੀਜ ਹੁੰਦੀਆਂ ਨੇ ਬਾਕੀ ਸਵੀਮਿੰਗ ਲਈ ਕਰ ਸਕਦੇ ਆ ਜੇ ਬੱਚੇ ਇੰਟਰਸਟਡ ਨੇ ਬਾਕੀ ਦੇਖੋ ਜੇ ਕਈ ਮਤਲਬ ਹੈਗੇ ਨੇ ਕੁਕਿੰਗ ਦੇ ਵਿੱਚ ਕਿਸੇ ਨੂੰ ਸ਼ੌਕ ਹੈ ਜਿਵੇਂ ਜ਼ਿਆਦਾਤਰ ਆਪਾਂ ਕਹਿ ਲਈਏ ਵੀ ਕੁੜੀਆਂ ਨੂੰ ਹੁੰਦਾ ਹੈ ਨਾ ਤਾਂ ਆਪਣੇ ਬੇਕਿੰਗ ਦੀਆਂ ਵੀ ਹੈਗੀਆਂ ਨੇ ਬੇਕਿੰਗ ਵਗੈਰਾ ਕੁਕਿੰਗ ਹੋ ਗਈ ਉਹਦੇ 'ਚ ਕਰ ਸਕਦੇ ਨੇ ਉਸ ਤੋਂ ਇਲਾਵਾ ਵੀ ਮਿਊਜ਼ਿਕ ਨਾਲ ਰਿਲੇਟਡ ਹੈਗੀਆਂ ਨੇ ਆਪਣੇ ਗੇਮਜ਼ ਜੇ ਕਿਸੇ ਜਵਾਕ ਨੂੰ ਹੈ ਨਾ ਵੇਖੋ ਸੰਗੀਤ ਦਾ ਜ਼ਿਆਦਾ ਉਹਦੇ ਜਾਂ ਸੰਗੀਤ ਵੱਲ ਜ਼ਿਆਦਾ ਰੁਝਾਨ ਹੈ ਉਹਦਾ ਤਾਂ ਉਹ ਬੰਦਾ ਵੀ ਕਰ ਸਕਦਾ ਨਾ ਇੱਦਾਂ ਮੈਡਮ ਦੇਖੋ ਆਪਦੇ ਆਪਦੇ ਪਰਸਨਲ ਦੇਖੋ ਇੰਟਰਸਟ ਦੇ ਅਕੋਡਿੰਗ ਆਪਣੇ ਇੱਥੇ ਕਲੱਬ ਦੇ ਵਿੱਚ ਅੱਡ ਅੱਡ ਸੁਵਿਧਾਵਾਂ ਦੇਖੋ ਹੈਗੀਆਂ ਨੇ ਇਹ ਮੈਡਮ ਹੁਣ ਤੁਸੀਂ ਬਾਕੀ ਉਹਨਾਂ ਦੇ ਮਾਂ ਪਿਓ ਨਾਲ ਗੱਲ ਕਰ ਲਿਓ ਬਾਕੀ ਤੁਸੀਂ ਦੱਸ ਦਿਓ ਤੁਸੀਂ ਵੀ ਕਿੱਦਾਂ ਦੀ ਐਕਟੀਵੀਟੀ 'ਚ ਉਹਨਾਂ ਨੂੰ ਕਰਾਉਣਾ ਚਾਹੁੰਦੇ ਹੋ ਮਤਲਬ ਤੁਸੀਂ ਦੱਸ ਦਿਉ ਮੈਡਮ ਮੈਂ ਤੁਹਾਨੂੰ ਦੱਸਦੀ ਹਾਂ ਵੀ ਇਹ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ

ਹਾਂਜੀ ਦੋਖੇ ਮਤਲਬ ਆਪਾਂ ਮਤਲਬ ਨਾ ਆਪਾਂ ਪੰਜ ਹਜ਼ਾਰ ਲੈਂਦੇ ਹਾਂ ਮਤਲਬ ਫੀਸ ਇੱਕ ਬੱਚੇ ਦੀ ਹਾਂਜੀ ਤਾਂ ਫਿਰ ਉਹ ਤੁਸੀਂ ਦੇਖ ਲਿਓ ਬਾਕੀ ਕੋਰਸ ਦੇ ਹਿਸਾਬ ਨਾਲ ਮੈਡਮ ਅੱਡ ਅੱਡ ਨੇ ਜਦੋਂ ਤੁਸੀਂ ਫਿਰ ਦੇਖੋ ਕੋਰਸ ਫਾਇਨਲ ਕਰ ਲਵੋਂਗੇ ਆਪਾਂ ਫਿਰ ਦੇਖ ਲਵਾਂਗੇ ਫੀਸ ਦਾ ਥੋੜ੍ਹਾ ਸਾਡਾ ਦੋ ਹਜ਼ਾਰ ਅਡਵਾਂਸ ਰਹੇਗਾ ਅਤੇ ਬਾਕੀ ਫਿਰ ਹਾਂਜੀ ਬਾਕੀ ਆਪਾਂ ਫਿਰ ਦੇਖ ਲਵਾਂਗੇ ਤੁਸੀਂ ਮੈਨੂੰ ਬਾਕੀ ਦੱਸ ਦਿਓ ਤੁਹਾਡੇ ਕਿੰਨੇ ਬੱਚੇ ਨੇ ਟੋਟਲ ਉਹਦੇ ਹਿਸਾਬ ਨਾਲ ਆਪਾਂ ਫੀਸ ਦਾ ਕੋਈ ਫੀਸ ਦਾ ਮੈਡਮ ਕੋਈ ਚੱਕਰ ਨਹੀਂ ਉਹ ਆਪਾਂ ਕਰ ਲਵਾਂਗੇ ਆਪਣੀ ਬਿਲਡਿੰਗ ਦੀ ਗੱਲ ਹੈ ਉਹ ਤਾਂ ਕੋਈ ਇਸ਼ੂ ਨਹੀਂ ਹੈਗਾ ਆਪਣੇ ਹੀ ਬੱਚੇ ਨੇ ਨਹੀਂ ਮੈਡਮ ਆਪਾਂ ਦੇਖੋ ਸਟਾਫ਼ ਆਪਣਾ ਪੂਰਾ ਸਟਾਫ਼ ਵੀ ਪੂਰਾ ਡੇਡੀਕੇਟਿਡ ਇੱਦਾਂ ਆਪਾਂ ਰੱਖਿਆ ਹੋਇਆ ਵੀ ਉਹ ਕੋਈ ਚੱਕਰ ਨਹੀਂ ਆਪਣੇ ਕੋਲ ਦੇਖੋ ਦੂਜੀਆਂ ਬਿਲਡਿੰਗ ਦੇ ਬੱਚੇ ਵੀ ਹੈ ਉਹ ਬੜੇ ਆਉਂਦੇ ਹੈ ਦੂਜਾ ਨੇੜੇ ਨੇੜੇ ਦੇ ਪਿੰਡਾਂ ਤੋਂ ਬੜੇ ਜਵਾਕ ਆਉਂਦੇ ਨੇ ਤਾਂ ਉਹ ਕੋਈ ਚੱਕਰ ਨਹੀਂ ਹੈਗਾ ਹਾਂਜੀ ਕੋਈ ਗੱਲ ਨਹੀਂ ਮੈਡਮ ਤੁਸੀਂ ਦੱਸ ਦਿਓ ਬਾਕੀ ਤੁਸੀਂ ਡੇਟ ਦੱਸ ਦਿਓ ਆਪਾਂ ਕਦੋਂ ਤੋਂ ਸ਼ੁਰੂ ਕਰਨਾ ਹੈਗਾ ਹਾਂ ਠੀਕ ਹੈ ਕੋਈ ਗੱਲ ਨਹੀਂ ਜੀ ਤੁਸੀਂ ਦੱਸ ਦਿਓ ਸਾਨੂੰ ਤੁਸੀਂ ਕਰ ਲਉ ਪਹਿਲਾਂ ਆਪਸ ਦੇ ਵਿੱਚ ਡਿਸਕਸ ਫਿਰ ਸਾਨੂੰ ਦੱਸ ਦਿਓ ਹਾਂਜੀ ਚਲੋ ਠੀਕ ਮੈਡਮ ਤੁਸੀਂ ਦੱਸ ਦਿਓ ਜੀ